ਸਾਡੇ ਇਲਾਕੇ ਵਿੱਚ ਕੱਪੜੇ ਅਤੇ ਕਲਾ ਦੇ ਵਿਸ਼ੇਸ਼ ਪ੍ਰਕਾਰ ਇਸ ਤਰ੍ਹਾਂ ਹਨ ਗਿਣਤੀ ਧਾਗਾ ਕਢਾਈ ਕੈਨਵਸ ਦਾ ਕੰਮ ਡਰੋਨ ਥਰੈਡ ਵਰਕ ਅਤੇ ਕਟਵਰਕ ਵਾਈਟਵਰਕ ਹਜ਼ਾਜ਼ਟ ਕਢਾਈ ਇੰਬੋਂਰਾਇਡਰੀ ਵਰਕ ਸੂਫ ਕਢਾਈ ਆਦਿ